ਹਾਂਜੀ ਅੱਜ ਆਪਾਂ ਗੱਲ ਕਰ ਰਹੇ ਆਂ ਬਗੀਚੇ ਦੀ ਸਾਂਭ ਸੰਭਾਲ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਦਾ ਜਿਵੇਂ ਕਿ ਮੱਛਰ ਕੀੜੇ ਮਕੌੜੇ ਆਦਿ ਇਹਨਾਂ ਗੱਲਾਂ ਦੀ ਦੇਖੋ ਜੀ ਬਗੀਚੀ ਦੀ ਗੱਲ ਕਰੀਏ ਤਾਂ ਘਰ ਦੇ ਵਿੱਚ ਸਭ ਤੋਂ ਉੱਤਮ ਜੋ ਹੈ ਘਰ ਦੇ ਵਿੱਚ ਬਗੀਚੀ ਦਾ ਹੋਣਾ ਇਸ ਨਾਲ ਹਵਾ ਤਾਂ ਸ਼ੁੱਧ ਹੁੰਦੀ ਆ ਨਾਲ ਨਾਲ ਕੀ ਹੈ ਹਰਿਆਲੀ ਵੀ ਘਰ ਦੇ ਵਿੱਚ ਰਹਿੰਦੀ ਹੈ ਮਿੱਟੀ ਦੀ ਵੀ ਸਾਂਭ ਸੰਭਾਲ ਰਹਿੰਦੀ ਆ ਜਿੱਦਾਂ ਕਿ ਗੁਰਬਾਣੀ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਧਰਤੀ ਦਾ ਮਹੱਤਵ ਆ ਜੋ ਸਾਡੇ ਲਈ ਬਹੁਤ ਜਿਆਦਾ ਇਸਨੂੰ ਸਾਂਭ ਸੰਭਾਲ ਦੇ ਲਈ ਘਰ ਦੇ ਵਿੱਚ ਵੀ ਛੋਟੀ ਮੋਟੀ ਬਗੀਚੀ ਜਿੱਦਾਂ ਆਪਾਂ ਰਸੋਈ ਬਗੀਚਾ ਕਹਿ ਦਿੰਨੇ ਆਂ ਜਿਹਦੇ ਵਿੱਚ ਅਸੀਂ ਸਬਜ਼ੀਆਂ ਫੁੱਲ ਆਦਿ ਲਗਾਉਨੇ ਆ ਇਹਨਾਂ ਦੀ ਸਾਂਭ ਸੰਭਾਲ ਕਰਨਾ ਵੀ ਬਹੁਤ ਜਰੂਰੀ ਆ ਸਮੱਸਿਆਵਾਂ ਵੀ ਆਉਂਦੀਆਂ ਨੇ ਬਿਮਾਰੀਆਂ ਵੀ ਪੈਂਦੀਆਂ ਨੇ ਮੱਛਰ ਕੀੜੇ ਮਕੌੜੇ ਵੀ ਪੈਂਦੇ ਨੇ ਉਹਨਾਂ ਦੇ ਲਈ ਕਈ ਵਾਰ ਜਹਿਰਾਂ ਦਾ ਛਿੜਕਾਅ ਵੀ ਕਰਦੇ ਆ ਤੇ ਕਈ ਵਾਰੀ ਹੱਥੀ ਕੁਝ ਨਾ ਕੁਝ ਕੋਈ ਦੇਸੀ ਜੁਗਾੜ ਨੁਕਤੇ ਕਰਕੇ ਵੀ ਆਪਾਂ ਕੀ ਆ ਇਹਨਾਂ ਦਾ ਖਾਤਮਾ ਕਰਦੇ ਆਂ ਜਿਵੇਂ ਕਿ ਕੱਦੂਆਂ ਦੀਆਂ ਵੇਲਾਂ ਦੀ ਗੱਲ ਕਰੀਏ ਕੱਦੂਆਂ ਦੀਆਂ ਵੇਲਾਂ ਸਭ ਤੋਂ ਪਹਿਲਾਂ ਜਦੋਂ ਲਗਾਈਆਂ ਤਾਂ ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਸਮੱਸਿਆ ਮੱਛਰ ਦੀ ਆਈ ਜੋ ਕਿ ਇਹਨਾਂ ਦੇ ਪੱਤੇ ਖਾ ਰਿਹਾ ਸੀ ਤੇ ਉਸਦੇ ਲਈ ਘਰੇਲੂ ਨੁਸਖਾ ਜਿਵੇਂ ਕਿ ਗੁੂਗਲ ਦੀ ਧੂਫ ਦੇ ਦਿੱਤੀ ਪਾਥੀਆਂ ਦਾ ਧੂੰਆਂ ਕਰ ਦਿੱਤਾ ਜਾਂ ਫਿਰ ਨਿੰਮ ਦਾ ਨੂੰ ਉਬਾਲ ਕੇ ਨਿੰਮ ਦੇ ਪਾਣੀ ਦਾ ਛਿੜਕਾਅ ਕਰ ਦਿੱਤਾ ਇਹ ਸਭ ਤੋਂ ਦੇਸੀ ਅਤੇ ਟਿਕਾਊ ਨੁਕਤੇ ਨੇ ਉਸ ਤੋਂ ਬਾਅਦ ਕੀੜੇ ਮਕੌੜਿਆਂ ਦੀ ਗੱਲ ਕਰੀਏ ਇਹਨਾਂ ਦੇ ਜੋ ਫੁੱਲ ਪੈਂਦੇ ਨੇ ਜਦੋਂ ਵੇਲਾਂ ਨੂੰ ਉਦੋਂ ਕੀੜੇ ਮਕੌੜੇ ਬਹੁਤ ਪੈਂਦੇ ਨੇ ਉਦੋਂ ਵੀ ਜਹਿਰਾਂ ਦਾ ਛਿੜਕਾਅ ਕਰਨ ਦੀ ਬਜਾਏ ਜੇਕਰ ਅਸੀਂ ਘਰੇਲੂ ਨੁਕਤੇ ਵਰਤ ਲਈਏ ਜਿੱਦਾਂ ਕਿ ਨਿੰਮ ਦਾ ਪਾਣੀ ਹੋ ਗਿਆ ਜਾਂ ਫਿਰ ਅੱਕ ਨੂੰ ਉਬਾਲ ਕੇ ਉਸਦਾ ਛਿੜਕਾਅ ਕਰ ਦਿੱਤਾ ਠੀਕ ਹੈ ਜੀ ਇਹ ਸਸਤੇ ਟਿਕਿਆਊ ਨੇ ਨਾਲੇ ਜੋ ਸਾਡੀ ਬਗੀਚੀ ਆ ਉਹ ਜਹਿਰ ਰਹਿਤ ਰਹਿੰਦੀ ਆ ਠੀਕ ਹੈ ਜੀ ਸੋ ਹਰ ਇੱਕ ਨੂੰ ਆਪਣੇ ਘਰ ਦੇ ਵਿੱਚ ਛੋਟੀ ਮੋਟੀ ਜਿਆਦਾ ਜੇਕਰ ਜਿਆਦਾ ਜਗ੍ਹਾ ਨਹੀਂ ਤਾਂ ਥੋੜੀ ਬਹੁਤੀ ਬਗੀਚੀ ਜਰੂਰ ਲਗਾਉਣੀ ਚਾਹੀਦੀ ਹੈ ਧੰਨਵਾਦ